ਸਾਨੂੰ ਜਦੋਂ ਵੀ ਕਦੀ ਕਿਤੇ ਸਫ਼ਰ ਕਰਨਾ ਹੈ ਤਾਂ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਘਰ ਵਿੱਚ ਕੁਝ ਲੇਡੀਜ ਨੂੰ ਰਸਤੇ ਵਿੱਚ ਜਾਂਦੇ ਹੋਏ ਉਲਟੀਆਂ ਲੱਗ ਜਾਂਦੀਆਂ ਹਨ ਉਹਦੇ ਲਈ ਕੋਈ ਮੈਡੀਸਨ ਕੋਈ ਸਿਰ ਦਰਦ ਦੀ ਦਵਾਈ ਕੁਝ ਨਾ ਕੁਝ ਬੈਗ ਵਿੱਚ ਪਾ ਕੇ ਰੱਖਣੀ ਚਾਹੀਦੀ ਹੈ ਜਦੋਂ ਅਸੀਂ ਕਿਤੇ ਆਪਣੇ ਪਰਸਨਲ ਵਹੀਕਲ 'ਤੇ ਜਾਣਾ ਹੈ ਤਾਂ ਉਸ ਦਾ ਟਾਇਰ ਟਿਊਬ ਚੰਗੀ ਤਰ੍ਹਾਂ ਚੈੱਕ ਕਰਨਾ ਚਾਹੀਦਾ ਹੈ ਅਤੇ ਸੀਟ ਬੈਲਟ ਜ਼ਰੂਰੀ ਲਗਾਉਣੀ ਚਾਹੀਦੀ ਹੈ ਰਸਤੇ ਵਿੱਚ ਚਲਦੇ ਸਮੇਂ ਚੌਂਕਾਂ ਦੇ ਵਿੱਚ ਰੈੱਡ ਲਾਈਟਾਂ ਆਉਂਦੀਆਂ ਹਨ ਉਹਨਾਂ ਰੈੱਡ ਲਾਈਟਾਂ 'ਤੇ ਪੂਰਾ ਧਿਆਨ ਰੱਖ ਕੇ ਗੱਡੀ ਰੋਕਣੀ ਚਾਹੀਦੀ ਹੈ ਅਤੇ ਗ੍ਰੀਨ ਲਾਈਟ ਹੋਏ 'ਤੇ ਚੱਲਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਰੈੱਡ ਲਾਈਟ 'ਤੇ ਰੈੱਡ ਗੱਡੀ ਕ੍ਰੋਸ ਕਰਦੇ ਹਾਂ ਤਾਂ ਸਾਡਾ ਐਕਸੀਡੈਂਟ ਜਾਂ ਦੁਰਘਟਨਾ ਹੋ ਸਕਦੀ ਹੈ ਇਸ ਕਰਕੇ ਸਾਨੂੰ ਗ੍ਰੀਨ ਲਾਈਟ 'ਤੇ ਹੀ ਚੱਲਣਾ ਚਾਹੀਦਾ ਹੈ ਰੈੱਡ ਲਾਈਟ ਹੋਈ 'ਤੇ ਰੁੱਕ ਜਾਣਾ ਚਾਹੀਦਾ ਹੈ ਪਹਾੜ ਵਿੱਚ ਚੱਲਦੇ ਸਮੇਂ ਸਾਨੂੰ ਹਰ ਮੋੜ ਦੇ ਉੱਪਰ ਹੋਰਨ ਵਜਾਉਣਾ ਚਾਹੀਦਾ ਹੈ ਤਾਂ ਕਿ ਸਾਹਮਣਿਓ ਆ ਰਹੀ ਗੱਡੀ ਵਾਲੇ ਨੂੰ ਪਤਾ ਲੱਗ ਸਕੇ ਕਿ ਅੱਗਿਓਂ ਕੋਈ ਗੱਡੀ ਤਾਂ ਨਹੀਂ ਆ ਰਹੀ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋਏ ਹੀ ਸਾਨੂੰ ਸਫ਼ਰ ਕਰਨਾ ਚਾਹੀਦਾ ਹੈ